ਹਾਂਜੀ ਹਾਂਜੀ ਨਮਸਕਾਰ ਜੀ ਨਰੇਸ਼ ਬੋਲਦਾ ਪਿਆ ਮੈਂ ਕੁਛ ਨਹੀਂ ਨੌਕਰੀ ਦੇ ਚੱਕਰ 'ਚ ਫਿਰਦਾ ਨੌਕਰੀ ਵਗੈਰਾ ਲੱਭਦਾ ਪਿਆ ਇੱਥੇ ਪਠਾਨਕੋਟ 'ਚ ਹੈਗੀ ਪਠਾਨਕੋਟ 'ਚ ਕੋਈ ਨੌਕਰੀ ਵਗੈਰਾ ਤੁਹਾਡੇ ਅੱਛਾ ਕਿੰਨੇ ਕੁ ਤੱਕ ਮਿਲ ਜਾਏਗੀ ਸੈਲਰੀ ਅੱਛਾ ਦਸ ਬਾਰਾਂ ਹਜ਼ਾਰ ਤੋਂ ਅੱਛਾ ਅੱਛਾ

ਨਹੀਂ ਮੋਲ 'ਚ ਵੀ ਮੈਂ ਪਤਾ ਤਾਂ ਕੀਤਾ ਸੀਗਾ ਮੋਲ ਦੇ ਵਿੱਚ ਮੋਲ ਦੇ ਮਿਲ ਜਾਵੇ ਮਤਲਬ ਕਿ ਬਾਰਾਂ ਤੇਰਾਂ ਹਜ਼ਾਰ ਰੁਪਈਆ ਉਹ ਵੀ ਦੇ ਛੱਡਦੇ ਹੈ ਨਾਲ ਕਿਰਾਇਆ ਵਗੈਰਾ ਵੀ ਆਉਣ ਜਾਉਣ ਦਾ ਦੇ ਦਿੰਦੇ ਹੈ ਹਾਂਜੀ ਹਾਂ ਹਾਂ ਹਾਂ ਹਾਂ ਠੀਕ ਹੈ ਹਾਂ ਹਾਂ ਹਾਂ ਹਾਂ ਚਲੋ ਕੋਈ ਨਹੀਂ ਉੱਧਰ ਹੀ ਦੇਖ ਲੈਂਦੇ ਫਿਰ ਕਿਉਂਕਿ ਇਹ ਇੱਧਰ ਤਾਂ ਫਾਇਦਾ ਕੋਈ ਨਹੀਂ ਮੋਲ ਵਗੈਰਾ 'ਚ ਇੱਧਰ ਸਿੱਧਾ ਅੱਠ ਘੰਟੇ ਦਸ ਘੰਟੇ ਬਾਰਾਂ ਘੰਟੇ ਡੀ ਡਿਊਟੀ ਦੇਣੇ ਪੈਂਦੀ ਹੈ ਅਤੇ ਹਾਂਜੀ ਹਾਂ ਹਾਂ ਉਹ ਠੀਕ ਹੈ ਠੀਕ ਠੀਕ ਹੈ ਜੀ ਓਕੇ ਜੀ